ਮੈਂ ਆਪਣੇ ਬੱਚ ਬੱਚਿਆਂ ਨੂੰ ਦਸਵੀਂ ਕਲਾਸ ਤੋਂ ਬਾਅਦ ਚੰਗੇ ਸਕੂਲ 'ਚ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਚੰਗੀ ਸ਼ਿਕਸ਼ਾ ਦਿੱਤੀ ਜਿਸ ਕਰਕੇ ਅੱਜ ਉਹ ਆਪਣੇ ਪੈਰਾਂ 'ਤੇ ਖੜ੍ਹੇ ਹਨ ਅਤੇ ਨਸ਼ਿਆਂ ਤੋਂ ਦੂਰ ਹਨ ਜਿਸ ਕਰਕੇ ਮੈਨੂੰ ਇਸ 'ਤੇ ਬਹੁਤ ਫ਼ਖ਼ਰ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਚੰਗੇ ਸਕੂਲ 'ਚ ਪੜ੍ਹਾਇਆ ਅਤੇ ਚੰਗੀ ਸ਼ਿਕਸ਼ਾ ਦਿੱਤੀ ਜਿਸ ਕਰਕੇ ਉਹ ਨਸ਼ਿਆਂ ਤੋਂ ਦੂਰ ਰਹੇ ਅਤੇ ਪਰਮਾਤਮਾ ਦੇ ਵੱਲ ਵੀ ਉਹਨਾਂ ਦਾ ਮਨ ਹੈ ਜਿਸ ਕਰਕੇ ਉਹ ਮੰਦਰ ਵੀ ਜਾਂਦੇ ਹਨ ਗੁਰਦੁਆਰਾ ਸਾਹਿਬ ਵੀ ਜਾਂਦੇ ਹਨ ਸਾਰੇ ਵੱਡਿਆਂ ਦਾ ਆਦਰ ਕਰਦੇ ਹਨ ਜਦੋਂ ਸਾਨੂੰ ਉਹਨਾਂ ਦੀ ਜ਼ਰੂਰਤ ਹੋਵੇ ਉਹ ਹਰ ਟਾਈਮ ਸਾਡੇ ਨਾਲ ਖੜ੍ਹੇ ਹਨ ਜੇਕਰ ਸਾਡੀ ਮਾਤਾ ਜੀ ਜਾਂ ਅਸੀਂ ਬਿਮਾਰ ਹੋ ਜਾਈਏ ਉਸੇ ਟਾਈਮ ਸਾਡੇ ਨਾਲ ਅੱਧੀ ਰਾਤ ਨੂੰ ਵੀ ਹੋਸਪਿਟਲ ਜਾਣ ਨੂੰ ਤਿਆਰ ਹਨ ਜਿਸ ਕਰਕੇ ਸਾਨੂੰ ਉਹਨਾਂ 'ਤੇ ਫ਼ਖ਼ਰ ਹੈ ਅਤੇ ਅੱਜ ਕੱਲ੍ਹ ਉਹ ਆਪਣੇ ਜੋਬ ਕਰਦੇ ਹਨ ਅਤੇ ਸਾਡਾ ਵੀ ਖਿਆਲ ਰੱਖਦੇ ਹਨ ਅਤੇ ਮੈਨੂੰ ਮਹੱਤਵਪੂਰਨ ਫ਼ੈਸਲਾ ਸਲਾਹ ਇਸ ਕਰਕੇ ਆਪਣੀ ਮਾਤਾ ਜੀ ਤੋਂ ਅਤੇ ਆਪਣੇ ਬੇਟਿਆਂ ਨਾਲ ਸਲਾਹ ਕਰਕੇ ਹੀ ਕੋਈ ਕੰਮ ਕਰਦਾ ਹਾਂ ਅਤੇ ਉਹਨਾਂ ਉਹ ਆਪਣੇ ਆਪਣੀ ਸਲਾਹ ਮੈਨੂੰ ਠੀਕ ਦਿੰਦੇ ਹਨ